ਕਿਸੇ ਵੀ ਬਿਮਾਰੀ ਨੂੰ ਠੀਕ ਕਰਨ ਲਈ ਪਿੰਡਾਂ ਵਿੱਚ ਘਰੇਲੂ ਨੁਸਖੇ ਬਹੁਤ ਹੀ ਹੁੰਦੇ ਹਨ ਕਿਸੇ ਵੀ ਬਿਮਾਰੀ ਨੂੰ ਜਲਦੀ ਤੋਂ ਜਲਦੀ ਰਾਹਤ ਪਾਉਣ ਲਈ ਘਰੇਲੂ ਨੁਸਖੇ ਕੰਮ ਆਉਂਦੇ ਹਨ ਇਹ ਹੈ ਅੰਗਰੇਜ਼ੀ ਦਵਾਈਆਂ ਨਾਲੋਂ ਬਹੁਤ ਹੀ ਬਿਹਤਰ ਹੁੰਦੇ ਹਨ ਇਸ ਕੋਈ ਵੀ ਹਾਨੀਕਾਰਕ ਨਹੀਂ ਹੁੰਦੇ ਅਤੇ ਅਤੇ ਇਸ ਨਾਲ ਜਲਦੀ ਬਿਮਾਰੀ ਤੋਂ ਰਾਹਤ ਮਿਲਦੀ ਹੈ ਘਰੇਲੂ ਨੁਸਖੇ ਅਪਣਾਉਣਾ ਬਹੁਤ ਹੀ ਆਸਾਨ ਹੁੰਦਾ ਹੈ ਅਤੇ ਇਸ ਨਾਲ ਛੇਤੀ ਰਾਹਤ ਮਿਲਦੀ ਹੈ ਜੇਕਰ ਆਪਾਂ ਪਿੱਠ ਦੇ ਦਰਦ ਦੀ ਗੱਲ ਕਰੀਏ ਤਾਂ ਪਿੰਡਾਂ ਵਿੱਚ ਘਰੇਲੂ ਨੁਸਖੇ ਕੁਛ ਇਹ ਹਨ ਪਿੱਠ ਦੇ ਦਰਦ ਨੂੰ ਠੀਕ ਕਰਨ ਲਈ ਗਰਮ ਪਾਣੀ ਦੀ ਸਿਕਾਈ ਕਰਨੀ ਚਾਹੀਦੀ ਹੈ ਪਾਣੀ ਗਰਮ ਕਰਕੇ ਇਹ ਕਿਸੇ ਕੱਚ ਦੀ ਬੋਤਲ ਵਿੱਚ ਪਾ ਕੇ ਅਤੇ ਪਿੱਠ ਦੇ ਉੱਤੇ ਰੱਖਣਾ ਚਾਹੀਦਾ ਸਰ੍ਹੋਂ ਦੇ ਤੇਲ ਦੀ ਪਿੱਠ 'ਤੇ ਮਾਲਿਸ਼ ਕਰਨੀ ਚਾਹੀਦੀ ਇਸ ਨਾਲ ਦਰਦ ਤੋਂ ਰਾਹਤ ਛੇਤੀ ਮਿਲ ਜਾਂਦੀ ਹੈ ਲਸਣ ਅਤੇ ਹਲਦੀ ਦਾ ਪੇਸਟ ਬਣਾ ਕੇ ਪਿੱਠ 'ਤੇ ਲਗਾਉਣ ਨਾਲ ਦਰਦ ਵਿੱਚ ਬਹੁਤ ਰਾਹਤ ਮਿਲਦੀ ਹੈ ਅਤੇ ਇਹ ਬਹੁਤ ਹੀ ਲਾਭਦਾਇਕ ਹੁੰਦਾ ਹੈ ਅਜਵਾਇਣ ਦਾ ਤੇਲ 'ਤੇ ਪਿੱਠ ਦੇ ਮਾਲਿਸ਼ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਗਰਮ ਦੁੱਧ ਪੀਣ ਨਾਲ ਪਿੱਠ ਦੇ ਦਰਦ ਵਿੱਚ ਰਾਹਤ ਮਿਲਦੀ ਹੈ ਗਰਮ ਦੁੱਧ ਵਿੱਚ ਹਲਦੀ ਪਾਉਣ ਵਾਲੀ ਦਰਦ ਤੋਂ ਬਹੁਤ ਜਲਦੀ ਰਾਹਤ ਮਿਲ ਜਾਂਦੀ ਹੈ ਉਸ ਤੋਂ ਬਾਅਦ ਯੋਗ ਅਤੇ ਵੀਆਮ ਕਰਨ ਲਈ ਪਿੱਠ ਦੇ ਦਰਦ ਤੋਂ ਰਾਹਤ ਮਿਲਦੀ ਹੈ ਯੋਗਾ ਕਰਨ ਨਾਲ ਵੀ ਪਿੱਠ ਤੋਂ ਰਾਹਤ ਮਿਲਦੀ ਹਰੇਕ ਹਰੇਕ ਅਨੇਕ ਪ੍ਰਕਾਰ ਦੇ ਯੋਗਾ ਕਰਨ ਨਾਲ ਪਿੱਠ ਤੋਂ ਰਾਹਤ ਮਿਲ ਜਾਂਦੀ ਹੈ ਪਿੱਠ ਦੇ ਦਰਦ ਵਿੱਚ ਰਾਹਤ ਪਾਉਣ ਲਈ ਆਰਾਮ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਪਿੱਠ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਤਾਂ ਆਪਾਂ ਨੂੰ ਆਰਾਮ ਦੀ ਸਥਿਤੀ ਵਿੱਚ ਹੋਣਾ ਚਾਹੀਦਾ ਹੈ ਅਤੇ ਜ਼ਿਆਦਾ ਕੰਮ ਨਹੀਂ ਕਰਨੇ ਚਾਹੀਦੇ ਅਤੇ ਨਾ ਹੀ ਜ਼ਿਆਦਾ ਭਾਰ ਚੁੱਕਣਾ ਚਾਹੀਦਾ ਇਸ ਨਾਲ ਪਿੱਠ ਦਾ ਦਰਦ ਜਲਦੀ ਠੀਕ ਹੋ ਜਾਵੇਗਾ ਇਹ ਘਰੇਲੂ ਨੁਸਖੇ ਪਿੱਠ ਦੇ ਦਰਦ ਤੋਂ ਰਾਹਤ ਪਾਉਣ ਲਈ ਮਦਦਗਾਰ ਸਿੱਧ ਹੁੰਦੇ ਹਨ